ਭੰਗੜਾ ਇੱਕ ਮਨੋਰੰਜਨ ਦਾ ਸਾਧਨ ਨਹੀਂ ਹਾਲਾਂਕਿ ਭੰਗੜਾ ਇਹ ਅੱਜ ਕੱਲ੍ਹ ਇੱਕ ਫਿਟਨਸ ਦਾ ਵੀ ਸਾਧਨ ਹੈ ਭੰਗੜਾ ਪਾ ਕੇ ਹਰ ਕੋਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਲਲੈਕਸ ਫੀਲ ਕਰਦਾ ਹੈ ਭੰਗੜਾ ਪਾਉਣ ਨਾਲ ਹਰ ਕਿਸੇ ਨੂੰ ਦਿਮਾਗੀ ਤੌਰ 'ਤੇ ਵੀ ਬਹੁਤ ਰਿਲੈਕਸ ਮਿਲਦਾ ਹੈ ਭੰਗੜਾ ਪਾ ਕੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਭੰਗੜਾ ਨਾ ਸਿਰਫ ਇੱਕ ਪੰਜਾਬ ਦਾ ਕਲ ਦਾ ਇੱਕ ਕਲਚਰ ਹੈ ਬਲਕਿ ਹਰ ਕਸ ਕੰਟਰੀ ਦੇ ਵਿੱਚ ਪ ਹਰ ਦੇਸ਼ ਦੇ ਵਿੱਚ ਭੰਗੜਾ ਪਾਇਆ ਜਾਂਦਾ ਹੈ ਜਦੋਂ ਵੀ ਕੋਈ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਵੀ ਫੀਲ ਕਰਦਾ ਹੈ ਹੈਵੀ ਫੀਲ ਕਰਦੇ ਹੈ ਉਹ ਭੰਗੜਾ ਪਾ ਕੇ ਆਪਣੇ ਆਪ ਦਾ ਦਿਮਾਗ ਸ਼ਾਂਤ ਕਰਦਾ ਹੈ ਭੰਗੜਾ ਪਾਉਣ ਨਾਲ ਹਰ ਕਿਸੇ ਦੇ ਦਿਲ ਖੁਸ਼ ਹੋ ਜਾਂਦਾ ਹੈ